ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ ਹਾਂਜੀ ਜੀ ਕਿਹੜਾ ਕਿਹੜਾ ਵਧੀਆ ਲੱਗਿਆ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਵਾਲਾ ਠੀਕ ਹੈ ਜੀ ਇਹ ਨੰਬਰ ਕੀ ਹੈ ਜੀ ਤੁਹਾਡਾ ਅੱਛਾ ਜੀ ਅਤੇ ਉਹਨਾਂ ਉਹ ਤੁਹਾਨੂੰ ਪੰਦਰਾਂ ਸੌ ਸੌਲਾਂ ਸੌ ਦੇ ਮਿਲ ਜਾਣਗੇ ਜੀ

ਅੱਛਾ ਅੱਛਾ

ਤੁਹਾਨੂੰ ਦਸ ਪ੍ਰਸੈਂਟ ਦਾ ਡਿਸਕਾਊਂਟ ਦੇ ਦਾਂਗੇ ਜੀ ਲੋਕੇਸ਼ਨ ਤੁਸੀਂ ਗਾਂਧੀ ਚੌਂਕ ਪਤਾ ਹੈ ਤੁਹਾਨੂੰ ਉੱਥੇ ਸਾਹਮਣੇ ਗਾਂਧੀ ਜੀ ਮੋਚੇ ਦੇ ਸਾਹਮਣੇ ਦੁਕਾਨ ਹੈਗੀ ਦੇਖਿਓ ਅੱਛਾ ਅੱਛਾ ਹਾਂਜੀ ਹਾਂਜੀ ਪੂਰਾ ਸ਼ੂ ਦਾ ਹੀ ਆ ਹਾਂਜੀ ਹਾਂਜੀ ਜ਼ਰੂਰ ਜੀ ਥੈਂਕ ਯੂ ਜੀ